ਤਕਨੋਲਜੀ ਸਾਡੇ ਦੁਆਰਾ ਜਾਣਕਾਰੀ ਤੱਕ ਪਹੁੰਚਣ ਅਤੇ ਵਰਤਣ ਦੇ ਤਰੀਕੇ ਨੂੰ ਬਹੁਤ ਜ਼ਿਆਦਾ ਬਦਲ ਰਹੀ ਹੈ ਪਹਿਲਾਂ ਜਿੱਥੇ ਸਾਨੂੰ ਕਿਤਾਬਾਂ ਜਾਂ ਦਸਤਾਵੇਜ਼ਾਂ ਦੇ ਜ਼ਰੀਏ ਜਾਣਕਾਰੀ ਪ੍ਰਾਪਤ ਕਰਨੀ ਪੈਂਦੀ ਸੀ ਹੁਣ ਇੰਟਰਨੈੱਟ ਅਤੇ ਡਿਜੀਟਲ ਪਲੇਟਫੋਮਾਂ ਦੇ ਨਾਲ ਸਾਨੂੰ ਤੁਰੰਤ ਅਤੇ ਵਿਆਪਕ ਜਾਣਕਾਰੀ ਮਿਲਦੀ ਹੈ ਡਾਟਾ ਇੰਟੀਗ੍ਰੇਸ਼ਨ ਨਾਲ ਸਾਨੂੰ ਵੱਖ ਵੱਖ ਸੋਰ ਸਰੋਤਾਂ ਤੋਂ ਜ਼ਿਆਦਾ ਸਹੀ ਅਤੇ ਸੰਪੂਰਨ ਜਾਣਕਾਰੀ ਮਿਲ ਸਕਦੀ ਹੈ ਉਦਾਰਹਨ ਦੇ ਤੌਰ 'ਤੇ ਔਨਲਾਈਨ ਬੈਂਕਿੰਗ ਨੇ ਵਿੱਤੀ ਲੈਣ ਦੇਣ ਨੂੰ ਬਹੁਤ ਆਸਾਨ ਅਤੇ ਤੁਰੰਤ ਬਣਾਇਆ ਹੈ ਵਿਦਿਆਰਥੀਆਂ ਲਈ ਘਰੇਲੂ ਕੰਮ ਵਿੱਚ ਮਦਦ ਕਰਨ ਵਾਲੀਆਂ ਐੱਪਸ ਅਤੇ ਸੋਫਟਵੇਅਰਾਂ ਨੇ ਉਨ੍ਹਾਂ ਦੀ ਸਿੱਖਣ ਦੀ ਪ੍ਰੀਕੀ ਪ੍ਰਕਿਰਿਆ ਨੂੰ ਬਹੁਤ ਸੁਖਦ ਅਤੇ ਦਖਸ਼ ਬਣਾਇਆ ਹੈ ਇਸ ਤਰ੍ਹਾਂ ਤੈਕਨਾਲੋਜੀ ਸਾਡੀ ਦਿਨਚਰੀ ਵਿੱਚ ਸੁਵਿਧਾ ਸਮਰਥਾ ਅਤੇ ਤੇਜ਼ੀ ਲਾ ਲਿਆਉਂਦੀ ਹੈ ਜਿਸ ਨਾਲ ਸਾਡੇ ਕੰਮਾਂ ਨੂੰ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਹੈ